ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਸਵਿਗੀ ਤੋਂ ਬੋਲ਼ ਰਹੇ ਹਨ ਐਕਚੁਲੀ ਮੇਰੇ ਆਫਿਸ ਦੇ ਕੁਝ ਮਿੱਤਰ ਆਉਣ ਲੱਗੇ ਹੈ ਅਤੇ ਉਨ੍ਹਾਂ ਲਈ ਨਾ ਮੈਂ ਟੇਬਲ ਬੁੱਕ ਕਰਵਾਉਣੇ ਸੀ ਉੱਥੇ ਕਿਆ ਚਾਰ ਬੰਦਿਆਂ ਲਈ ਸੀਟ ਉਪਲੱਬਧ ਹੈ ਮੇਰੀ ਨਾ ਇੱਕ ਮੀਟਿੰਗ ਵੀ ਹੈ ਉਹ ਚਾਰ ਬੰਦਿਆਂ ਨਾਲ ਅਤੇ ਉਨ੍ਹਾਂ ਨਾਲ ਆਪਾਂ ਆਫਿਸ ਦਾ ਹੀ ਕੁਛ ਜ਼ਰੂਰੀ ਗੱਲਾਂ ਪੁੱਛਣੀਆਂ ਹਨ ਅਤੇ ਸ਼ਾਇਦ ਹੋ ਸਕਦਾ ਸਾਨੂੰ ਕੁਛ ਸੁੱਕੀ ਸਬਜ਼ੀ ਅਤੇ ਰੋਟੀ ਵੀ ਖਾਣੀ ਪੈ ਸਕਦੀ ਹੈ ਡਿਨਰ ਦੇ ਟਾਈਮ 'ਤੇ ਅਤੇ ਇਸ ਲਈ ਚਾਰ ਬੰਦਿਆਂ ਦਾ ਤੁਸੀਂ ਕਿਰਪਾ ਕਰਕੇ ਕੁਛ ਉਪਲੱਬਧ ਕਰਨ ਦੀ ਕੋਸ਼ਿਸ਼ ਕਰੋ ਜੀ